ਮੈਂ ਵਾਇਰਲੈਸ ਏਅਰਬਡ ਇੱਕ ਔਨਲਾਈਨ ਖਰੀਦਿਆ ਵਾ ਉਹਦੀ ਕੁਆਲਟੀ ਇੰਨੀ ਅੱਛੀ ਆ ਕਿ ਉਹ ਬਹੁਤ ਵਧੀਆ ਅਵਾਜ਼ ਦਿੰਦਾ ਆ ਸਿਰਫ਼ ਮੈਂ ਚਾਹੇ ਰਾਈਟ ਸੈਡ ਜਾਂ ਲੈਫਟ ਸੈਡ ਲਗਾਮਾਂ ਉਹ ਬਹੁਤ ਵਧੀਆ ਆਵਾਜ਼ ਦਿੰਦਾ ਵਾ ਚਾਹੇ ਇੱਕ ਸਾਈਡ ਤੋਂ ਹੀ ਲੈਫਟ ਸੈਡ ਤੋਂ ਹੀ ਸੁਣਾਂ ਪਰ ਉਹਦੀ ਕੁਆਲਟੀ ਮਤਲਬ ਇੰਨਾ ਸਮੂਦ ਆ ਉਹ ਈਅਰ 'ਚ ਜਿਹੜਾ ਪਾਉਂਦੇ ਹਾਂ ਬਹੁਤ ਹੈ ਨਾ ਅੱਛੀ ਆਵਾਜ਼ ਦਾ ਵਾ ਕਿ ਉਹਦਾ ਕਲਰ ਵੀ ਬਹੁਤ ਵਧੀਆ ਵਾ ਮੈਨੂੰ ਬਹੁਤ ਪਸੰਦ ਆਇਆ ਵਾ ਅਤੇ ਮੈਂ ਆਪਣੇ ਫ੍ਰੇਂਡ ਨੂੰ ਵੀ ਕਹੂੰਗੀ ਕਿ ਤੁਸੀਂ ਇਹਦੇ ਹੀ ਏਅਰਬਡ ਖਰੀਦੋ ਅਤੇ ਪੀ ਬਹੁਤ ਅੱਛਾ ਵਾ ਕੁਵਾਲਟੀ ਬਹੁਤ ਅੱਛੀ ਆ ਪ੍ਰਾਈਜ਼ ਬਹੁਤ ਵਧੀਆ ਵਾ ਕਿ ਤੁਸੀਂ ਇਹ ਹੀ ਖਰੀਦੋ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜੋ ਮੈਂ ਖਰੀਦਿਆ ਵਾ ਏਅਰਬਡ ਅਤੇ ਤੁਸੀਂ ਉਹ ਹੀ ਖਰੀਦੋ ਅਤੇ ਬਾਕੀ ਮੈਨੂੰ ਆਪਣਾ ਏਅਰਬਡ ਬਹੁਤ ਪਸੰਦ ਆ ਮੈਂ ਉਹਨੂੰ ਲਗਾ ਕੇ ਗਾਣੇ ਸੁਣਦੀ ਹਾਂ ਮਿਊਜ਼ਿਕ ਸੁਣਦੀ ਹਾਂ ਜਦੋਂ ਮੈਂ ਟਾਈਮ ਕੰਮ ਕਰਦੀ ਹਾਂ ਘਰ ਦਾ ਤਾਂ ਮੈਂ ਏਅਰਬਡ ਲਗਾ ਕੇ ਕਿ ਆਪਣੇ ਉਸ ਮਿਊਜ਼ਿਕ ਸੁਣਦੀ ਹਾਂ ਮੈਨੂੰ ਅੱਛਾ ਲੱਗਦਾ ਆ ਮੈਨੂੰ ਇਹਦੀ ਆਵਾਜ਼ ਸਮੂਦਿੰਗ ਬਹੁਤ ਵਧੀਆ ਲੱਗਦੀ ਹੈ ਥੈਂਕ ਊ